ਸਾਡੇ ਖੇਤਰ ਵਿੱਚ ਧਾਰਮਿਕ ਸਮਾਗਮਾਂ ਵਿੱਚ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾਏ ਜਾਂਦੇ ਹਨ ਉਹਨਾਂ ਦਾ ਆਯੋਜਨ ਕਰਨ ਵਾਸਤੇ ਬੜੇ ਵੱਡੇ ਗਿਣਤੀ ਦੇ ਵਿੱਚ ਬੜੇ ਵੱਡੇ ਪੰਡਾਲ ਲਗਾਏ ਜਾਂਦੇ ਹਨ ਜਿਹਦੇ ਵਿੱਚ ਕੀਰਤਨ ਦਰਬਾਰ ਹੁੰਦਾ ਹੈ ਉਹ ਲੋਕਾਂ ਲਈ ਸਾਰੀ ਸੰਗਤ ਲਈ ਅਟੁੱਟ ਲੰਗਰ ਵਰਤਾਇਆ ਜਾਂਦਾ ਹੈ